ਸਾਡੇ ਪਰਿਵਾਰ ਦੇ ਵਿੱਚ ਅਸੀਂ ਪੰਜ ਜੀਅ ਹਾਂ ਮੈਂ ਹਾਂ ਮੇਰਾ ਫੌਜੀ ਮੁੰਡਾ ਮੇਰਾ ਪੋਤਾ ਘਰਵਾਲੀ ਹੈ ਅਤੇ ਮੇਰੀ ਨੂੰਹ ਹੈ ਸਾਡੇ ਵਿੱਚੋਂ ਜਿਹੜਾ ਮੇਰਾ ਮੁੰਡਾ ਫੌਜੀ ਆ ਉਹ ਬਾਗਬਾਨੀ ਦੇ ਵਿੱਚ ਬਹੁਤ ਵਧੀਆ ਦਿਲਚਸਪੀ ਦਿਖਾਉਂਦਾ ਹੈ ਅਤੇ ਉਹ ਬਾਗ ਆਪਣੇ ਗਮਲਿਆਂ ਦੇ ਵਿੱਚ ਬੂਟੇ ਲਾਉਂਦਾ ਸੁਬਹਾ ਸ਼ਾਮ ਉਹਨਾਂ ਨੂੰ ਪਾਣੀ ਪਾਉਂਦਾ ਉਹਨਾ ਦੀ ਦੇਖ ਰੇਖ ਕਰਦਾ ਉਹ ਨਾਲ ਉਹਦੇ ਘਰਵਾਲੀ ਵੀ ਸਾਡੀ ਨੂੰਹ ਰਾਣੀ ਉਹਦੇ ਨਾਲ ਲੱਗਦੀ ਹੈ ਪਰ ਅਸੀਂ ਨਹੀਂ ਕਿਤੇ ਨੇ ਉਹਨਾਂ ਨੂੰ ਕੁਝ ਆਖਿਆ ਵੀ ਕਿਉਂ ਲਾਉਂਦੇ ਹੋ ਕਿਉਂ ਨਹੀਂ ਅਤੇ ਜਗ੍ਹਾ ਬਹੁਤ ਹੈ ਅਤੇ ਰੋਜ਼ ਹਰ ਰੋਜ਼ ਇੱਕ ਨਵਾਂ ਬੂਝਾ ਲਿਆ ਕੇ ਲਾਉਂਦੇ ਨੇ ਕਦੇ ਆਖਦੇ ਨੇ ਕਿ ਤੁਲਸੀ ਦਾ ਬੂਝਾ ਇਹਦੀ ਪੂਜਾ ਕਰਨੀ ਚਾਹੀਦੀ ਹੈ ਪਰ ਮੈਂ ਇਸ ਦੇ ਬਰਖਿਲਾਫ ਹਾਂ ਪੂਜਾ ਇਹ ਦਰੱਖਤਾਂ ਦੀ ਪੂਜਾ ਪਾਜਾ ਕੁਛ ਨਹੀਂ ਹੁੰਦੀ ਪਰ ਫਿਰ ਵੀ ਉਹ ਲਵਾ ਦਿੰਦੇ ਨੇ ਹੁਣ ਉਹਨਾਂ ਨੇ ਇੱਕ ਪਿੱਪਲ ਦਾ ਪੇੜ ਲਾਤਾ ਜਿਹੜੇ ਸਾਡੇ ਜ਼ਮਾਨੇ ਦੇ ਵਿਚ ਅਸੀਂ ਬਾਹਰ ਘਰ 'ਚ ਪਿੱਪਲ ਲੱਗ ਗਿਆ ਇਹ ਇੱਕ ਬੋਹੜ ਦਾ ਬੂਝਾ ਲਾ ਰੱਖਿਆ ਹੁਣ ਉਹਨਾਂ ਦੀ ਇਹ ਸੁਬਹ ਸ਼ਾਮ ਇਸ਼ਨਾਨ ਕਰਵਾਉਂਦੇ ਨੇ ਉਹਨਾਂ ਨੂੰ ਪਾਣੀ ਪਾਉਂਦੇ ਨੇ ਖਾਦ ਪਾਉਂਦੇ ਨਾ ਪੂਰਾ ਖਿਆਲ ਰੱਖਦੇ ਹਨ ਧੁੱਪ ਛਾਵੇਂ ਰੱਖਦੇ ਨਾ ਪਰ ਵੀ ਉਹਨਾਂ ਦੀ ਮਿਹਨਤ ਹੈ ਜੇ ਚੰਗੀ ਹੈ ਤਾਂ ਚੰਗੇ ਫੁੱਲ ਨਾਲ ਚੰਗੇ ਘਰ ਦੇ ਵਿੱਚ ਸੁਗੰਧੀ ਆਉਂਦੀ ਹੈ ਅਤੇ ਸ ਅਸੀਂ ਤਾਂ ਬਸ ਦੇਖ ਹੀ ਸਕਦੇ ਹਾਂ ਕੰਮ ਤਾਂ ਸਾਡੇ ਤੋਂ ਹੁੰਦਾ ਨਹੀਂ ਅਤੇ ਸਾਡਾ ਪੋਤਾ ਵੀ ਇਸ ਬਾਗਬਾਨੀ ਦੇ ਵਿੱਚ ਕਾਲਜ ਦੇ ਵਿੱਚ ਪੜ੍ਹਦਾ ਉਹ ਉੱਥੋਂ ਬੂਝੇ ਲਿਆਉਂਦਾ ਬਠਿੰਡਿਓ ਖੇਤੀਬਾੜੀ ਦਫਤਰ ਦੇ ਵਿੱਚ ਜਾਂਦਾ ਕਈ ਵਾਰੀ ਉਹ ਲੁਧਿਆਣੇ ਵੀ ਚਲੇ ਜਾਂਦੇ ਨੇ ਉੱਥੋਂ ਬੂਝੇ ਲੈ ਕੇ ਆਏ ਨੇ ਇੱਕ ਅੱਜ ਕੱਲ੍ਹ ਪਰਸੋਂ ਦਾ ਨਵਾਂ ਬੂਝਾ ਲਿਆਂਦਾ ਅਸੀਂ ਤਾਂ ਅੱਜ ਤੱਕ ਇਹ ਵੇਖਿਆ ਨਹੀਂ ਪੰਜਾਬ 'ਚ ਇਹ ਕੜੀ ਪੱਤਾ ਹੈ ਹੁਣ ਕੜੀਆਂ ਦੇ ਵੀ ਪੱਤੇ ਹੋਣ ਲੱਗ ਗਏ ਜੀ ਦੇਖ ਲਓ ਕੀ ਬਣੇਗਾ